ਸਮਾਜ ਉਹਨਾਂ ਔਰਤਾਂ ਨੂੰ ਸਮਰਥਨ ਨਹੀਂ ਦੇ ਕਰਨ ਦਾ ਜੋ ਡਾਂਸ ਨੂੰ ਇੱਕ ਸ਼ੌਕ ਤੌਰ 'ਤੇ ਜਾਰੀ ਰੱਖਣਾ ਚਾਹੁੰਦੇ ਹਨ ਬੱਟ ਮੇਰੇ ਹਿਸਾਬ ਨਾਲ ਸ਼ੌਕ ਵੀ ਠੀਕ ਹੈ ਬੱਟ ਇਹ ਹੈ ਕਿ ਕੋਈ ਸ਼ੌਕ ਲਈ ਕਰਦਾ ਹੈ ਡਾਂਸ ਕੋਈ ਮਜਬੂਰੀ ਲਈ ਕਰਦਾ ਹੈ ਜਿਵੇਂ ਕਿ ਕੋਈ ਆਪਣੇ ਪੜ੍ਹਿਆ ਲਿਖਿਆ ਘੱਟ ਹੁੰਦਾ ਹੈ ਔਰਤਾਂ ਉਹਨਾਂ ਨੂੰ ਰੋਟੀ ਪਾਣੀ ਜੋਗਾ ਮਤਲਬ ਆਪਣੇ ਘਰ ਟੱਬਰ ਚਲਾਉਣ ਲਈ ਕੁਛ ਡਾਂਸ ਕਰਨਾ ਵੀ ਪੈਂਦਾ ਹੈ ਜੋ ਕਿ ਸਮਾਜ ਇਸ ਚੀਜ਼ ਨੂੰ ਗਲਤ ਤ ਸਮਰਥਨ ਨਹੀਂ ਦਿੰਦਾ ਹੈ ਮਤਲਬ ਕਹਿਣ ਦਾ ਇਹ ਹੈ ਕਿ ਮਤਲਬ ਹਰ ਕੋਈ ਆਪਣੇ ਲਈ ਜ਼ਰੂਰੀ ਨਹੀਂ ਹੈ ਕਿ ਡਾਂਸ ਔਰਤਾਂ ਲਈ ਬਣਿਆ ਹੈ ਜਾਂ ਮ ਮਰਦਾਂ ਲਈ ਬਣਿਆ ਹੈ ਡਾਂਸ ਇੱਕ ਐਕਟੀਵੀਟੀ ਹੈ ਜੋ ਕਿ ਆਪਣੇ ਆਪਣੇ ਆਪ ਨੂੰ ਖੁਸ਼ ਅਤੇ ਵਧੀਆ ਸਕੂਨ ਦੇਣ ਦਾਇਕ ਹੈ ਇਸਨੂੰ ਜਿਵੇਂ ਜਿਵੇਂ ਕਿ ਅਸੀਂ ਆਖੀਏ ਕਿ ਜੋ ਕੁੜੀਆਂ ਜਾਂ ਔਰਤਾਂ ਪੰਜਾਬੀ ਸੱਭਿਆਚਾਰ ਨਾਲ ਭੰਗੜਾ ਕਰਦੇ ਹਨ ਜਾਂ ਗਿੱਧਾ ਪਾਉਂਦੇ ਹਨ ਉਹ ਇੱਕ ਅਲੱਗ ਚੀਜ਼ ਹੈ ਬੱਟ ਜਿਹੜੀ ਚੀਜ਼ ਲੋਕ ਵਿਆਹਾਂ ਵਿੱਚ ਆਪਣੇ ਸੱਭਿਆਚਾਰ ਬੁਲਾਉਂਦੇ ਹਨ ਕਰਦੇ ਹਨ ਉਸਨੂੰ ਔਰਤਾਂ ਨੂੰ ਬੜਾ ਕੁਛ ਦੇਖਣਾ ਸੁਣਨਾ ਪੈਂਦਾ ਹੈ ਜਿਸਨੂੰ ਕਿ ਜਿੱਦਾਂ ਕਿ ਵਿਆਹਾਂ ਵਿੱਚ ਅੱਜ ਕੱਲ੍ਹ ਆਮ ਸੱਭਿਆਚਾਰ ਪ੍ਰੋਗਰਾਮ ਲੱਗਦਾ ਹੈ ਅਤੇ ਉਸਨੂੰ ਜਿਵੇਂ ਕਿ ਮਰਦ ਵਿਆਹਾਂ ਵਿੱਚ ਖਾਧੀ ਪੀਤੀ ਹੁੰਦੀ ਹੈ ਅਤੇ ਜਾਂ ਉਹਨਾਂ ਨਾਲ ਗਲਤ ਮਤਲਬ ਵਿਹਾਰ ਕਰਦੇ ਹਨ ਜਾਂ ਕਿੱਦਾਂ ਵੀ ਕਰਕੇ ਬੱਟ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਵੀ ਕੋਈ ਵੀ ਕੰਮ ਹੈ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਕੀਤਾ ਜਾਂਦਾ ਹੈ ਕਿ ਉਸਨੂੰ ਕੋਈ ਵੀ ਗਲਤ ਨਜ਼ਰ ਨਾਲ ਦੇਖਣਾ ਜਾਂ ਕਰਨਾ ਉਹ ਸਭ ਤੋਂ ਗਲਤ ਗੱਲ ਹੈ ਕਿਉਂਕਿ ਜੋ ਵੀ ਕੋਈ ਡਾਂਸ ਜਾਂ ਸਟੇਜ 'ਤੇ ਔਰਤਾਂ ਕਰਦੀਆਂ ਹਨ ਜਾਂ ਕਿੱਦਾਂ ਵੀ ਹੈ ਉਸਨੂੰ ਉਹਨਾਂ ਦੀ ਮਜਬੂਰੀ ਕਰਕੇ ਕਈ ਲੋਕ ਫਾਇਦਾ ਉਠਾਉਂਦੇ ਹਨ ਜਾਂ ਕਿੱਦਾਂ ਵੀ ਕਰਕੇ ਬੱਟ ਇਹ ਚੀਜ਼ ਨਹੀਂ ਕਦੀ ਵੀ ਹੋਣੀ ਚਾਹੀਦੀ ਮੇਰੇ ਮੁਤਾਬਕ ਇਹ ਹੈ ਕਿ ਕੰਮ ਤਾਂ ਕੰਮ ਹੈ ਜਿਵੇਂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਜਿੱਦਾਂ ਦਾ ਮਰਜ਼ੀ